ਅੱਜ ਦੇ ਸਮੇਂ ਵਿੱਚ ਮੈਨੂੰ ਸਭ ਤੋਂ ਜ਼ਿਆਦਾ ਕਪਿਲ ਸ਼ਰਮਾ ਦਾ ਸ਼ੋ ਪਸੰਦ ਹੈ ਇਸ ਵਿੱਚ ਅਲੱਗ ਅਲੱਗ ਲੋਕ ਆਪਣੇ ਕਿਰਦਾਰਾਂ ਨੂੰ ਨਿਭਾਉਂਦੇ ਹੋਏ ਸਭ ਨੂੰ ਹਸਾਉਂਦੇ ਹਨ ਜਦੋਂ ਵੀ ਮੈਂ ਕਿਸੇ ਕਾਰਨ ਉਦਾਸ ਹੁੰਦੀ ਹਾਂ ਤਾਂ ਮੈਂ ਕਪਿਲ ਸ਼ਰਮਾ ਦਾ ਸ਼ੋਅ ਲਗਾ ਕੇ ਬੈਠ ਜਾਂਦੀ ਹਾਂ ਜਿਸ ਨੂੰ ਦੇਖ ਕੇ ਮੈਨੂੰ ਬਹੁਤ ਖੁਸ਼ੀ ਮਿਲਦੀ ਹੈ ਇੱਥੇ ਲੋਕ ਆਪਣੇ ਅਨੁਭਵਾਂ ਬਾਰੇ ਖੁੱਲ੍ਹੇ ਦਿਲ ਨਾਲ ਦੱਸਦੇ ਹਨ ਮੈਨੂੰ ਅਗਰ ਮੌਕਾ ਮਿਲਿਆ ਤਾਂ ਮੈਂ ਛੁੱਟੀਆਂ ਵਿੱਚ ਕਪਿਲ ਸ਼ਰਮਾ ਦਾ ਸ਼ੋਅ ਦੇਖਣ ਲਈ ਜ਼ਰੂਰ ਜਾਵਾਂਗੀ